ਅੱਜ ਕੱਲ ਦੇ ਟਾਈਮ ਦੇ ਵਿੱਚ ਖਾਣੇ ਨੂੰ ਲੈ ਕੇ ਅਸੀਂ ਬਹੁਤ ਹੀ ਇਸ ਚੀਜ਼ ਦਾ ਧਿਆਨ ਰੱਖਦੇ ਹਾਂ ਕਿੱਦਾਂ ਸਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ ਜੋ ਸਾਡੇ ਸਰੀਰ ਨੂੰ ਸਹੀ ਰੱਖੇ ਇਸ ਕਰਕੇ ਉਹ ਹਿਸਾਬ ਦੇ ਨਾਲ ਉਸ ਹਿਸਾਬ ਦੇ ਨਾਲ ਸਾਨੂੰ ਚੀਜ਼ ਲੈਣੀ ਚਾਹੀਦੀ ਹੈ ਜਿਹੜਾ ਕਿ ਸਾਨੂੰ ਜਲਦੀ ਡਾਇਜਸ ਜ ਜਲਦੀ ਹੀ ਪਚ ਜਾਵੇ ਜਿੱਦਾਂ ਦੁਪਹਿਰੇ ਅਸੀਂ ਚਪਾਤੀ ਔਰ ਔਰ ਸਬਜ਼ੀ ਨਾਲ ਚਪਾਤੀ ਖਾਂਦੇ ਹਾਂ ਹੈ ਨਾ ਜੋ ਕਿ ਸਾਨੂੰ ਦਿਨ ਦੇ ਵਿੱਚ ਉਹ ਪਚ ਜਾਂਦੀ ਹੈ ਅਸੀਂ ਰਾਤ ਨੂੰ ਬਹੁਤ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਹੁਤ ਹਲਕਾ ਲਈਏ ਔਰ ਟਾਈਮ ਟਾਈਮ ਟਾਈਮ ਤੋਂ ਪਿ ਮਤਲਬ ਸੱਤ ਅੱਠ ਵਜੇ ਤੋਂ ਪਹਿਲੇ ਆਪਾਂ ਆਪਣਾ ਜਿਹੜਾ ਰਾਤ ਦਾ ਖਾਣਾ ਖਾ ਲਈਏ ਜਿਸ ਤਰ੍ਹਾਂ ਜਿੰਨੇ ਅਸੀਂ ਜਲਦੀ ਖਾਵਾਂਗੇ ਓਨਾ ਹੀ ਸਾਡਾ ਖਾਣਾ ਜਿਹੜਾ ਪਚਦਾ ਇਸ ਕਰਕੇ ਮੈਂ ਇਹ ਕੋਸ਼ਿਸ਼ ਕਰਦੀ ਹਾਂ ਕਿ ਦਿਨ ਦੇ ਟਾਈਮ ਦੇ ਉੱਤੇ ਸਵੇਰੇ ਦਸ ਦੇ ਵਿੱਚ ਦੋ ਚਪਾਤੀਆਂ ਸਬਜ਼ੀ ਦੇ ਨਾਲ ਲੈ ਲਈਓ ਹੈ ਨਾ ਉਸ ਤੋਂ ਬਾਅਦ ਅਸੀਂ ਥੋੜ੍ਹਾ ਜਿਵੇਂ ਦੁਪਹਿਰ ਦਾ ਖਾਣਾ ਆਇਆ ਉਦੋਂ ਅਸੀਂ ਕੋਸ਼ਿਸ਼ ਕਰੀਏ ਕਿ ਥੋੜ੍ਹਾ ਸੈਲੇਡ ਜਾਂ ਫਰੂਟ ਇਹਨਾਂ ਚੀਜ਼ਾਂ ਨੂੰ ਲੈ ਕੇ ਉ ਉੱਨਾਂ ਖਾ ਲਈਏ ਚਾਹੇ ਅਸੀਂ ਉਹਨੂੰ ਸਕਿਪ ਵੀ ਕਰ ਸਕਦੇ ਹਾਂ ਕਰ ਲੈਂਦੇ ਹਾਂ ਕਈ ਵਾਰੀ ਸਕਿਪ ਵੀ ਕਰ ਦੇਣਾ ਜ਼ਿਆਦਾਤਰ ਅਸੀਂ ਹਿਊਮਨ ਸੈਲਡ ਲੈ ਲੈਂਦੇ ਹਾਂ ਔਰ ਰਾਤ ਨੂੰ ਜਦੋਂ ਛੇ ਸਾਢੇ ਛੇ ਹੁੰਦੇ ਉਦੋਂ ਆਪਾਂ ਥੋੜ੍ਹਾ ਜਿਹਾ ਹਲਕਾ ਜਿੱਦਾਂ ਦਲੀਆਂ ਕਸਟਡ ਔਰ ਪੋਹਾ ਅਤੇ ਹਲਕੇ ਖਾਣੇ ਜਿੱਦਾਂ ਅਸੀਂ ਕਹਿ ਸਕਦੇ ਹਾਂ ਅਸੀਂ ਉਲ ਉਹਨੂੰ ਲੈਣਾ ਪਸੰਦ ਕਰਦੇ ਹਾਂ ਜੋ ਜਿੱਦਾਂ ਮਤਲਬ ਕਿ ਰਾਤ ਦੇ ਟਾਈਮ 'ਤੇ ਸਾਨੂੰ ਉੱਨਾਂ ਕ ਚੀ ਉਹੋ ਜਿਹੀ ਚੀਜ਼ ਲੈਣੀ ਚਾਹੀਦੀ ਜਿਹੜੀ ਸਾਨੂੰ ਸੌਣ ਤੱਕ ਸਾਡੀ ਛੇਤੀ ਦੇ ਨਾਲ ਜਿਹੜਾ ਉਹਨੂੰ ਉਹਨੂੰ ਪਚਾ ਸਕੀਏ ਇਸ ਕਰਕੇ ਆਪਾਂ ਨੂੰ ਛੇ ਸੱਤ ਵਜੇ ਤੋਂ ਪਹਿਲੇ ਪਹਿਲੇ ਆਪਣਾ ਖਾਣਾ ਖਾਣਾ ਚਾਹੀਦਾ ਹੈ ਮੈਂ ਇਹੀ ਕਰਦੀ ਹਾਂ ਕਿ ਮੈਂ ਛੇ ਸਾਢੇ ਛੇ ਦੇ ਵਿੱਚ ਆਪਣਾ ਰਾਤ ਦਾ ਜੋ ਵੀ ਅਸੀਂ ਹਲਕਾ ਫੁਲਕਾ ਜੋ ਵੀ ਖਾਣਾ ਹੁੰਦਾ ਅਸੀਂ ਉਹ ਖਾ ਲੈਂਦੇ ਹਾਂ ਧੰਨਵਾਦ ਜੀ